ਮੈਂ ਦੂਜੇ ਧਰਮਾਂ ਨਾਲ਼ ਰਹਿਣਾ ਸਹਿਣਾ ਅਤੇ ਹੋਰ ਕਈ ਤਰ੍ਹਾਂ ਦੇ ਐਸੇ ਕਾਰਜ ਸਿੱਖੇ ਹਨ ਜੋ ਕਿ ਦੂਜੇ ਧਰਮਾਂ ਵਿੱਚ ਕੀਤੇ ਜਾਂਦੇ ਹਨ ਮੈਂ ਉਹਨਾਂ ਦੀ ਮਦਦ ਵੀ ਕਰਦਾ ਹਾਂ ਅਤੇ ਉਹਨਾਂ ਨਾਲ਼ ਗੱਲ ਬਾਤ ਕਰਨਾ ਅਤੇ ਰਹਿਣਾ ਬਹਿਣਾ ਮੈਨੂੰ ਵੀ ਚੰਗਾ ਲੱਗਦਾ ਹੈ ਸਾਰੇ ਧਰਮ ਇੱਕੋਂ ਤਰ੍ਹਾਂ ਦੇ ਹੁੰਦੇ ਹਨ ਹਰੇਕ ਧਰਮ ਆਪਣੇ ਆਪਣੇ ਧਰਮ ਲਈ ਬਹੁਤ ਹੀ ਯੋਗਦਾਨ ਪਾਉਂਦੇ ਹਨ ਅਤੇ ਮੈਂ ਹਰੇਕ ਧਰਮ ਨੂੰ ਬਰਾਬਰ ਹੀ ਸਮਝਦਾ ਹਾਂ